ਜਿਵੇਂ ਕਿ ਪਹਿਲੇ ਪ੍ਰਸ਼ਨ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਿਆ ਹੈ ਜੀ ਹਾਂ ਮੈਂ ਬਹੁਤ ਸਾਰੇ ਮੁਕਾਬਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਆਪਣੀ ਕਲਾਕਾਰੀ ਦਿਖਾਈ ਹੈ ਮੈਂ ਕੁਦਰਤ ਦੇ ਨਾਲ ਕਿ ਕੁਦਰਤ ਨੂੰ ਬਚਾਉ ਇਸ 'ਤੇ ਵਿਸ਼ੇ ਦੇ ਉੱਪਰ ਕਾਫੀ ਜ਼ਿਆਦਾ ਕਲਾਕਾਰੀ ਅਤੇ ਡਰਾਇੰਗਾਂ ਬਣਾਈਆਂ ਹਨ ਇਹ ਅਨੁਭਵ ਮੇਰੀ ਜ਼ਿੰਦਗੀ ਦੇ ਲਈ ਸਭ ਤੋਂ ਹੀ ਬੈਸਟ ਸਭ ਤੋਂ ਹੀ ਵਧੀਆ ਅਨੁਭਵ ਰਿਹਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਪ੍ਰਦਰਸ਼ਨੀ ਜਾਂ ਮੁਕਾਬਲੇ ਵਿੱਚ ਭਾਗ ਲੈਦੇ ਹਾਂ ਤਾਂ ਸਾਨੂੰ ਉੱਥੇ ਨਵੀਆਂ ਤਰ੍ਹਾਂ ਦੀਆਂ ਡਰਾਇੰਗਾਂ ਅਤੇ ਨਵੇਂ ਤਰ੍ਹਾਂ ਦੇ ਖਿੱਚ ਦੇ ਕੇਂਦਰ ਦੇਖਣ ਨੂੰ ਮਿਲਦੇ ਹਨ ਜਿਸ ਵਿੱਚ ਅਸੀਂ ਨਵੀਆਂ ਚੀਜ਼ਾਂ ਨਵੀਆਂ ਤਕਨੀਕਾਂ ਜੋ ਅੱਜ ਕੱਲ੍ਹ ਚੱਲ ਰਹੀਆਂ ਹਨ ਉਹ ਸਾਨੂੰ ਪਤਾ ਚੱਲਦੀਆਂ ਹਨ ਕਿਉਂਕਿ ਅਸੀਂ ਪੇਂਡੂ ਖੇਤਰ ਵਿੱਚ ਰਹਿੰਦੇ ਹਾਂ ਤਾਂ ਕਰਕੇ ਸਾਨੂੰ ਜਦੋਂ ਅਸੀਂ ਸ਼ਹਿਰੀ ਖੇਤਰ ਵਿੱਚ ਜਾਦੇ ਹਾਂ ਤਾਂ ਉੱਥੇ ਜੋ ਟੈਕਨੋਲਜੀ ਦੇ ਮਾਧਿਅਮ ਦੇ ਨਾਲ ਡਰਾਇੰਗ ਜੋ ਕਿ ਪ੍ਰਦਰਸ਼ਨੀਆਂ ਵਿੱਚ ਦਿਖਾਈ ਜਾਂਦੀ ਹੈ ਸਾਨੂੰ ਉਸ ਬਾਰੇ ਚਾਨਣਾ ਉਸ ਬਾਰੇ ਪਤਾ ਚੱਲਦਾ ਹੈ ਅਤੇ ਅਸੀਂ ਉਸ ਨੂੰ ਆਪਣੀ ਪ੍ਰਦਰਸ਼ ਆਪਣੀ ਕਲਾਕਾਰੀ ਦੇ ਵਿੱਚ ਦਿਖਾ ਦਿਖਾਉਂਦੇ ਹਾਂ